ਹਾਂਜੀ ਸਰ ਪਰ ਇਹ ਇੱਕ ਗੱਲ ਸਰਕਾਰ ਵੱਲੋਂ ਆ ਵੀ ਵੀ ਵਧੀਆ ਕੀਤੀ ਗਈ ਹੈ ਵੀ ਸਰਕਾਰੀ ਹੋਸਪੀਟਲ ਖੋਲ੍ਹੇ ਗਏ ਜਿੱਥੇ ਗਰੀਬ ਜਨਤਾ ਆਮ ਆਮ ਇਨਸਾਨ ਵੀ ਆਪਣਾ ਫ੍ਰੀ ਇਲਾਜ ਕਰਵਾ ਸਕਦਾ ਗਾ ਹਾਂਜੀ ਸਰ ਆਪ ਦੇਖੋ ਹੁਣ ਆਪ ਜੱਚਾ ਬੱਚਾ ਹੋਸਪੀਟਲਾਂ ਵਿੱਚ ਆਪਾਂ ਜਾਂਦੇ ਹਾਂ ਗੇ ਉੱਥੇ ਜਿਹੜੀਆਂ ਲੇਡੀਸ ਹੁੰਦੀਆਂ ਗੀਆਂ ਗਰੀਬ ਗਰੀਬ ਘਰਾਂ ਦੇ ਵੀ ਕੇਸ ਕਰਵਾਉਂਦੇ ਆ ਉੱਥੇ ਜਿਹੜੇ ਜ਼ਿਆਦਾ ਸਰਕਾਰੀ ਪ੍ਰਾਈਵੇਟ ਹੋਸਪਿਟਲਾਂ ਵਿੱਚ ਨਹੀਂ ਜਾ ਸਕਦੇ ਹੈਗੇ ਅਤੇ ਹਾਂਜੀ ਸਰ ਉੱਥੇ ਜਾ ਕੇ ਆਪਣਾ ਇਲਾਜ ਕਰਵਾਉ ਆਪਣਾ ਮਤਲਬ ਡਿਲੀਵਰੀ ਹੁੰਦੀ ਹੈ ਬੱਚੇ ਦੀ ਹਾਂ ਸਰ ਕਈ ਹੋਸਪਿਟਲਾਂ ਵਿੱਚ ਵੀ ਵਧੀਆ ਇਲਾਜ ਕੀਤਾ ਜਾਂਦਾ ਗਾ ਸਾਰੇ ਸੁੱਖ ਸਹੂਲਤ ਦਿੱਤੀ ਜਾਂਦੀ ਹੈਗੀ ਦਵਾਈਆਂ ਟਾਈਮ ਸਿਰ ਦਿੱਤੀਆਂ ਜਾਂਦੀਆਂ ਗੀਆਂ ਹਾਂਜੀ ਸ ਸਰਕਾਰੀ ਹੋਸਪਿਟਲਾਂ ਵਿੱਚ ਇਲਾ ਅੱਖਾਂ ਦੀ ਅੱਖਾਂ ਦੀ ਦਵਾਈ ਦਿੱਤੀ ਜਾਂਦੀ ਆ ਫਰੀ ਇਲਾਜ ਕੀਤੇ ਜਾਂਦੇ ਆ ਲੈਂਸ ਪਾਏ ਜਾਂਦੇ ਆਗੇ ਹੁਣ ਸਰਕਾਰ ਵੱਲੋਂ ਪੰਜ ਲੱਖ ਦਾ ਕਾਰਡ ਵੀ ਬਣਵਾਇਆ ਗਿਆ ਗਾ ਜਿਹਦੇ ਉੱਤੇ ਪੰਜ ਲੱਖ ਤੱਕ ਵੀ ਆਪਣਾ ਕੋਈ ਵੀ ਆਪਣਾ ਇਲਾਜ ਆਪਾਂ ਫਰੀ ਕਰਵਾ ਸਕਦੇ ਹਾਂ ਵੀ ਕੋਈ ਪੈਸਾ ਨਹੀਂ ਲੱਗਦਾ ਗਾ ਹਾਂਜੀ ਸਰ ਹਾਂਜੀ ਸਰ

ਹਾਂਜੀ ਸਰ ਵੀ ਉੱਥੇ ਇੱਕ ਨਰਸਾਂ ਦੁਆਰਾ ਵੀ ਇਹ ਵੀ ਵੀ ਪ੍ਰੋਪਰ ਗੱਲ ਨਹੀਂ ਕਰੀ ਜਾਂਦੀ ਗੀ ਗੁੱਸੇ ਵਿੱਚ ਬੋਲਿਆ ਜਾਂਦਾ ਗਾ ਹਾਂਜੀ ਸਰ ਉੱਥੋਂ ਦਾ ਸਟਾਫ ਵਿੱਚ ਵੀ ਬਹੁਤ ਹੁੰਦਾ ਜਦੋਂ ਵੀ ਹੈ ਵੀ ਇੱਕ ਮਰੀਜ਼ ਦੇ ਉੱਪਰ ਇੱਕ ਸਟਾਫ ਨਹੀਂ ਰੱਖਿਆ ਜਾਂਦਾ ਜਾਂ ਇੱਕ ਨਰਸ ਨਹੀਂ ਰੱਖੀ ਜਾਂਦੀ ਗੀ ਇੱਕ ਸਿਸਟਰ ਨਹੀਂ ਰੱਖੀ ਜਾਂਦੀ ਉੱਥੇ ਵੀ ਹਾਜ਼ਰ ਉਹ ਵੀ ਕੋਈ ਰਾਊਂਡ ਮਾਰਨ ਆਉਂਦਾ ਤਾਂ ਇੱਕ ਵਾਰ ਗੇੜਾ ਮਾਰ ਕੇ ਜਾਂਦਾ ਜਦੋਂ ਕੋਈ ਸੂਈ ਵਗੈਰਾ ਲਗਾਉਣੀ ਹੋਵੇ ਉਦੋਂ ਵੀ ਹੈ ਕੋਈ ਹਮਦਰਦੀ ਨਹੀਂ ਕਰੀ ਕਰੀ ਜਾਂਦੀ ਵੀ ਬਹੁਤ ਧੱਕੇ ਨਾਲ ਸੂਈਆਂ ਲਗਾਈਆਂ ਜਾਂਦੀਆਂ ਹਾਂਜੀ ਸਰ ਬਾਕੀ ਉੱਥੋਂ ਦੀ ਸਾਫ ਸਫਾਈ ਦਾ ਹੋ ਜਾਂਦਾ ਵੀ ਸਾਫ਼ ਸਫਾਈ ਵੀ ਉੱਥੇ ਸਿਰਫ਼ ਇੱਕ ਟਾਈਮ ਕੀਤੀ ਜਾਂਦੀ ਆ ਇਹ ਨਹੀਂ ਹੈਗਾ ਵੀ ਹਰ ਟਾਈਮ ਹੀ ਕਰੀ ਜਾ ਰਿਹਾ ਵੀ ਉੱਥੇ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਵੀ ਸਰਕਾਰ ਵੱਲੋਂ ਵੀ ਇੰਨੀ ਸਰਕਾਰ ਵੱਲੋਂ ਵੀ ਇਹ ਅਪੀਲ ਕੀਤੀ ਜਾਂਦੀ ਹੈ ਸਾਡੀ ਵੀ ਸਰਕਾਰੀ ਹੋਸਪਿਟਲਾਂ ਵਿੱਚ ਸਾਰੀ ਸੁੱਖ ਸੁਵਿਧਾ ਦਿੱਤੀ ਜਾਵੇ ਤਾਂ ਜੋ ਵੀ ਇੱਕ ਗਰੀਬ ਇਨਸਾਨ ਵੀ ਆਪਣਾ ਪ੍ਰੋਪਰ ਇਲਾਜ ਕਰਵਾ ਸਕੇ ਸਹੀ ਤਰੀਕੇ ਨਾਲ ਇਲਾਜ ਕਰਵਾ ਸਕੇ ਵੀ ਉਹਨਾਂ ਨੂੰ ਇਲਾਜ ਕਰਵਾਉਣ ਵਿੱਚ ਕੋਈ ਮੁਸ਼ਕਿਲ ਨਾ ਆਵੇ ਅਤੇ ਵੀ ਉਹ ਘੱਟ ਰੇਟ ਵਿੱਚ ਦੀ ਫਰੀ ਇਲਾਜ ਕਰਵਾ ਸਕੇ ਵੀ ਉੱਥੇ ਉਹਨੂੰ ਪੂਰੀ ਸ ਉਹ ਧਿਆਨ ਦੇਖਭਾਲ ਕੀਤੀ ਜਾਵੇ ਉੱਥੋਂ ਹਾਂਜੀ ਸਰ ਹਾਂਜੀ ਹਾਂਜੀ ਤਾਂ ਹੀ ਲੋਕ ਸਰਕਾਰ ਹੋਸਪਿਟਲਾ ਛੱਡ ਕੇ ਪ੍ਰਵਾਈ ਪ੍ਰਾਈਵੇਟ ਹੋਸਪਿਟਲਾਂ ਵਿੱਚ ਜਾਂਦੇ ਕਿਉਂਕਿ ਪ੍ਰਾਈਵੇਟ ਹੋਸਪਿਟਲਾਂ ਵਿੱਚ ਹਰ ਇੱਕ ਪੇਸ਼ੈਂਟ ਉੱਤੇ ਇੱਕ ਨਰਸ ਛੱਡੀ ਜਾਂਦੀ ਹੈ ਵੀ ਹਾਂ ਵੀ ਪ੍ਰੋਪਰ ਧਿਆਨ ਰੱਖ ਸਕੇ ਵਾਸ਼ਰੂਮ ਕਰਨ ਵੇਲੇ ਵੀ ਲੇਡੀਸ ਨੂੰ ਨਾਲ ਭੇਜ ਸਕਣ ਹਾਂਜੀ ਸਰ ਸਾਡੀ ਸਰਕਾਰ ਵੱਲੋਂ ਬਸ ਇੱਕ ਹੀ ਅਪੀਲ ਆ ਵੀ ਸਰਕਾਰੀ ਹੋਸਪਿਟਲਾਂ ਵਿੱਚ ਸਹੀ ਪ੍ਰੋਪਰ ਇਲਾਜ ਕੀਤਾ ਜਾਵੇ ਉੱਥੇ ਪ੍ਰੋਪਰ ਸਟਾਫ ਦਿੱਤਾ ਜਾਵੇ ਅਤੇ ਸਾਰਾ ਉੱਥੋਂ ਦਾ ਸਟਾਫ ਐ ਹੈ ਐਜੂਕੇਟਡ ਹੋਵੇ ਜਿਨ੍ਹਾਂ ਨੂੰ ਪੂਰੀ ਜਾਣਕਾਰੀ ਹੋਵੇ ਅਤੇ ਉੱਥੇ ਸਾਫ਼ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਹਾਂਜੀ ਸਰ ਹਾਂਜੀ ਵੀ ਸਰਕਾਰ ਵੱਲੋਂ ਵੀ ਬਹੁਤ ਸੁਣ ਤਾਂ ਹਰ ਇੱਕ ਪਿੰਡ ਵਿੱਚ ਵੀ ਸਰਕਾਰੀ ਹੋਸਪੀਟ ਵੀ ਖੋਲ੍ਹ ਦਿੱਤਾ ਗਿਆ ਜਿੱਥੇ ਬੰਦਾ ਨੋਰਮਲ ਆਪਣਾ ਚੈੱਕਅਪ ਕਰਵਾ ਸਕਦਾ ਗਾ ਦਵਾਈ ਵਗੈਰਾ ਲੈ ਸਕਦਾ ਗਾ ਬਸ ਵੀ ਸ ਸਰਕਾਰ ਵੱਲੋਂ ਆ ਹੀ ਕੀਤੀ ਜਾਂਦੀ ਹੈ ਵੀ ਤੁਸੀਂ ਵੀ ਹੋਸਪਿਟਲ ਵਧੀਆ ਤੋਂ ਵਧੀਆ ਵੀ ਖੋਲ੍ਹਣ ਉੱਥੇ ਸਟਾਫ ਪੂਰਾ ਕੀਤਾ ਜਾਵੇ ਥੈਂਕ ਯੂ ਸੋ ਮੱਚ ਸਰ